ਔਰਤਾਂ ਨੂੰ ਮਾਹਵਾਰੀ ਦੇ ਵਿੱਚ ਗਰਮ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ ਜਿਵੇਂ ਕਿ ਜਵੈਨ ਹੋ ਗਈ ਖੋਪਾ ਹੋ ਗਿਆ ਤਿਲ ਹੋ ਗਏ